ਗੌਰਮੈਂਟ ਦੁਨੀਆ ਦੇ ਵਾਸਤੇ ਬਹੁਤ ਕੁਛ ਕਰ ਰਹੀ ਹੈ ਬਹੁਤ ਇਹਨਾਂ ਮੁੱਦਿਆਂ 'ਤੇ ਬਹੁਤ ਧਿਆਨ ਦੇ ਰਹੀ ਹੈ ਸਿੱਖਿਆ ਦੇ ਨਵੇਂ ਨਵੇਂ ਸਕੂਲ ਖੁੱਲ੍ਹ ਰਹੇ ਹੈ ਜਿਵੇਂ ਮਤਲਬ ਪ੍ਰਾਈਵੇਟ ਸਕੂਲਾਂ ਦੇ ਵਿੱਚ ਕਹਿੰਦੇ ਵੀ ਗੌਰਮੈਂਟ ਸਕੂਲ ਵਿੱਚ ਆ ਬੱਚੇ ਪੜ੍ਹਨ ਅਤੇ ਉਹਨਾਂ ਨਾਲ ਉਹਦਾ ਜਿਹੜਾ ਅੱਛਾ ਬਣਾਵੇ ਤੋਂ ਲੈ ਕੇ ਉਨ੍ਹਾਂ ਕੁਰਸੀਆਂ ਦੇ ਰਹੇ ਹੈ ਉਨ੍ਹਾਂ ਨੂੰ ਕਿਤਾਬਾਂ ਦੇ ਰਹੇ ਹੈ ਉਨ੍ਹਾਂ ਨੂੰ ਮਤਲਬ ਅੱਗੇ ਨਾਲੋਂ ਬਹੁਤ ਜ਼ਿਆਦਾ ਸੰਭਾਲ ਕਰ ਰਹੇ ਹੈ ਬੱਚਿਆਂ ਨੂੰ ਉਨ੍ਹਾਂ ਵਾਸਤੇ ਖਾਣਾ ਵੀ ਦੇ ਰਹੇ ਹੈ ਆਪਣਾ ਵੀ ਬੱਚੇ ਜਿਹੜੇ ਗਰੀਬ ਹੈ ਉਹ ਆਪਣਾ ਖਾ ਪੀ ਕੇ ਅਤੇ ਵਿੱਦਿਆ ਸੋਹਣੀ ਮਤਲਬ ਪੜ੍ਹ ਸਕਣ ਉਹਦੇ ਵਾਸਤੇ ਧਿਆਨ ਦੇ ਰਹੀ ਹੈ ਸਿਵਲ ਹਸਪਤਾਲਾਂ ਵਾਲੇ ਵੀ ਬਹੁਤ ਮਰੀਜ਼ਾਂ ਨੂੰ ਮਤਲਬ ਧਿਆਨ ਦੇ ਰਹੀ ਹੈ ਓ ਜ਼ਿਆਦਾ ਮਤਲਬ ਉਨ੍ਹਾਂ ਦਾ ਧਿਆਨ ਕਰ ਰਹੀ ਹੈ ਫ੍ਰੀ ਦਵਾਈ ਦੇ ਰਹੀ ਹੈ ਘਰ ਸਸਤੀਆਂ ਦਵਾਈਆਂ ਦੇ ਰਹੀ ਹੈ ਜਿਹਨਾਂ ਉਨ੍ਹਾਂ ਨੂੰ ਕਹਿੰਦੇ ਵੀ ਹੋਰ ਬਹੁਤ ਮੁੱਦਿਆਂ ਦੇ ਵਿੱਚ ਸਿਹਤ ਸੰਭਾਲ ਸਿਹਤ ਵਾਸਤੇ ਬਹੁਤ ਵਧੀਆ ਕਰ ਰਹੀ ਹੈ ਗੌਰਮੈਂਟ ਅਤੇ ਅੱਗੇ ਨਾਲੋਂ ਬਜਟ ਬਣਾਉਂਦੀ ਹੈ ਓ ਕਈ ਚੀਜ਼ਾਂ ਮਹਿੰਗੀਆਂ ਹੋ ਜਾਂਦੀਆਂ ਕਈ ਸਸਤੀਆਂ ਹੋ ਜਾਂਦੀਆਂ ਉਹ ਮਤਲਬ ਪੂਰਾ ਧਿਆਨ ਕਰਦੀ ਹੈ ਵੀ ਕਿਹਦੇ ਵੱਲ ਕੀ ਕਰਨਾ ਅਤੇ ਕੀ ਨਹੀਂ ਕਰਨਾ ਪੂਰਾ ਧਿਆਨ ਦੇ ਕੇ ਅਤੇ ਗੌਰਮੈਂਟ ਜਿਹੜੀ ਹੈ ਅੱਗੇ ਨਾਲ ਅੱਗੇ ਨਾਲ ਜ਼ਿਆਦਾ ਅੱਛਾ ਵੱਧਦੀ ਪਈ ਹੈ ਕਰਦੀ ਪਈ ਹੈ ਪਰਮਾਤਮਾ ਧੰਨਵਾਦ